ਅਸੀਂ ਅੰਤਰ ਭਾਈਚਾਰਕ ਲੜਾਈਆਂ ਬਾਰੇ ਜਾਣਦੇ ਹਾਂ ਜਿਸ ਦਾ ਬਹੁਤ ਲੰਬਾ ਇਤਿਹਾਸ ਹੈ ਹਾਂਜੀ ਫਤਿਹਗੜ੍ਹ ਸਾਹਿਬ ਵਿੱਚ ਇੱਕ ਇਤਿਹਾਸਿਕ ਅਸਥਾਨ ਹੋਣ ਕਰਕੇ ਇੱਥੋਂ ਦਾ ਇਤਿਹਾਸ ਬਹੁਤ ਲੰਬਾ ਹੈ ਇੱਥੇ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਲੜਾਈ ਹੋਈ ਸੀ ਪਹਿਲਾਂ ਇੱਥੇ ਵਜ਼ੀਰ ਖਾਂ ਸਰਹੰਦ ਦਾ ਨਵਾਬ ਹੋਇਆ ਕਰਦਾ ਸੀ ਜੋ ਕਿ ਬਹੁਤ ਹੀ ਜ਼ਾਲਮ ਨਵਾਬ ਸੀ ਸਰਹੰਦ ਇੱਕ ਬਹੁਤ ਹੀ ਉਚੇਰੀ ਥਾਂ ਰੱਖਦਾ ਸੀ ਕਿਉਂਕਿ ਇਹ ਲਾਹੌਰ ਅਤੇ ਦਿੱਲੀ ਦੇ ਬਿਲਕੁਲ ਵਿਚਕਾਰ ਪੈਂਦਾ ਹੈ ਇੱਥੇ ਹਰ ਕੋਈ ਅਹਿਲਕਾਰ ਜਾਂ ਰਾਜਾ ਇੱਥੇ ਆ ਕੇ ਆਰਾਮ ਕਰਦਾ ਸੀ ਜਦੋਂ ਵੀ ਉਹ ਦਿੱਲੀ ਤੋਂ ਲਾਹੌਰ ਜਾਂ ਲਾਹੌਰ ਤੋਂ ਦਿੱਲੀ ਜਾਂਦਾ ਸੀ ਪਰੰਤੂ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਾਰ ਸਿੰਘ ਜੋ ਕਿ ਨੌ ਸਾਲ ਦੀ ਉਮਰ ਦੇ ਸਨ ਅਤੇ ਬਾਬਾ ਫਤਿਹ ਸਿੰਘ ਜੀ ਜੋ ਕਿ ਸੱਤ ਸਾਲ ਦੀ ਉਮਰ ਦੇ ਸਨ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਸੀ ਉਸ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਸਰਹੰਦ ਵਿੱਚ ਵਜ਼ੀਰ ਖਾਂ ਨੂੰ ਸਤਾਰ੍ਹਾਂ ਸੌ ਦਸ ਵਿੱਚ ਹਰਾ ਕੇ ਇਸ ਸਥਾਨ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ ਅਤੇ ਇੱਥੇ ਖਾਲਸੇ ਝੰਡੇ ਲਹਿਰਾਇਆ ਸੀ ਅਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਆਪਣਾ ਲੋਹਾ ਮਨਵਾਇਆ ਸੀ ਇਸ ਤੋਂ ਬਾਅਦ ਵੀ ਇੱਥੇ ਬਹੁਤ ਸਾਰੀਆਂ ਲੜਾਈਆਂ ਹੁੰਦੀਆਂ ਰਹੀਆਂ ਅਤੇ ਉਸ ਲੜਾਈਆਂ ਤੋਂਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਸਥਾਪਨਾ ਇਸ ਇਲਾਕੇ ਵਿੱਚ ਕੀਤੀ ਸੀ ਹੁਣ ਉੱਥੇ ਇਸ ਅਸਥਾਨ 'ਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਹੈ ਅਤੇ ਹਰ ਸਾਲ ਇੱਥੇ ਵਾਰ ਗਿਆਰ੍ਹਾਂ ਬਾਰ੍ਹਾਂ ਤੇਰ੍ਹਾਂ ਪੋਹ ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਯਾਦ ਕਰਕੇ ਜੋੜ ਮੇਲਾ ਲੱਗਦਾ ਹੈ ਇਸ ਜੋੜ ਮੇਲੇ ਵਿੱਚ ਬਹੁਤ ਹੀ ਭਾਰੀ ਇਕੱਠ ਹੁੰਦਾ ਹੈ ਅਤੇ ਬਹੁਤ ਸਾਰੇ ਲੰਗਰ ਵੀ ਲੱਗਦੇ ਹਨ ਹਰ ਸਾਲ ਜੋੜ ਮੇਲਾ ਲੱਗਣ ਦੇ ਕਾਰਨ ਇਹ ਅਸਥਾਨ 'ਤੇ ਇਹ ਘਟਨਾਵਾਂ ਇਤਿਹਾਸਿਕ ਘਟਨਾਵਾਂ ਸਾਨੂੰ ਹਰ ਸਾਲ ਇਹ ਯਾਦ ਕਰਵਾਉਂਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਅਸੀਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੋ ਕਿ ਜ਼ੁਲਮ ਦੇ ਖਿਲਾਫ ਸ਼ਹੀਦ ਹੋਏ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਇਹ ਘਟਨਾਵਾਂ ਸਾਨੂੂੰ ਕਦੇ ਵੀ ਨਹੀਂ ਭੁੱਲਦੀਆਂ ਕਿਉਂਕਿ ਇਹ ਫਤਿਹਗੜ੍ਹ ਸਾਹਿਬ ਦੇ ਇਤਿਹਾਸਿਕ ਘਟਨਾਵਾਂ ਬਣ ਚੁੱਕੀਆਂ ਹਨ ਅਸੀਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਅਤੇ ਇਸ ਘਟਨਾਵਾਂ ਇਹਨਾਂ ਨੇ ਮੇਰੇ ਮਨ ਨੂੰ ਬਹੁਤ ਹੀ ਡੂੰਘਾ ਅਸਰ ਪਾਇਆ ਹੈ ਮੈਨੂੰ ਖ਼ੁਸ਼ੀ ਵੀ ਹੈ ਕਿ ਅਸੀਂ ਇਸ ਅਸਥਾਨ 'ਤੇ ਇਤਿਹਾਸਿਕ ਜਗ੍ਹਾ 'ਤੇ ਕਈ ਸਮੇਂ ਤੋਂ ਰਹਿ ਰਹੇ ਹਾਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਇਸ ਇਤਿਹਾਸਿਕ ਸਥਾਨ ਤੋਂ ਅਸੀਂ ਬਹੁਤ ਕੁਝ ਸਿੱਖਿਆ ਹੈ